ਵੈਸੇ ਤਾਂ ਸਾਡੇ ਪਿੰਡ ਦੇ ਵਿੱਚ ਬਹੁਤ ਵਿਕਾਸ ਹੋਇਆ ਹੈ ਪਰ ਫਿਰ ਵੀ ਕੁਝ ਗੱਲਾਂ ਨੇਗੀਆਂ ਜਿਹੜੀਆਂ ਕਿ ਸਾਡੇ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇਗੀਆਂ ਉਹ ਇਹ ਹੈ ਵੀ ਸਾਡੇ ਪਿੰਡ ਦੇ ਵਿੱਚ ਸੜਕਾਂ ਦਾ ਜਿਹੜਾ ਨਿਰਮਾਣ ਉਹ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ ਅਤੇ ਦੂਸਰੀ ਗੱਲ ਇਹ ਹੈ ਵੀ ਸਾਡੇ ਸਕੂਲ ਦੇ ਵਿੱਚ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਟੀਚਰਸ ਦੀ ਬਹੁਤ ਘਾਟ ਹੈ ਤਾਂ ਉਹ ਜਿਹੜੀ ਘਾਟ ਹੈ ਉਹ ਜ਼ਰੂਰ ਪੂਰੀ ਹੋਣੀ ਚਾਹੀ ਹੋਣੀ ਚਾਹੀਦੀ ਆ ਜਿਹਦੇ ਨਾਲ ਬੱਚਿਆਂ ਦਾ ਜਿਹੜਾ ਕੀ ਆ ਨੁਕਸਾਨ ਨਾ ਹੋਵੇ ਉਹ ਚੰਗੀ ਪੜ੍ਹਾਈ ਹਾਸਲ ਕਰ ਸਕਣ ਅਤੇ ਆਪਣਾ ਜਿਹੜਾ ਜੀਵਨ ਆ ਉਹ ਚੰਗੀ ਤਰ੍ਹਾਂ ਦੇ ਨਾਲ ਉਹ ਜੀਓ ਸਕਣ ਦੂਸਰੀ ਗੱਲ ਇਹ ਹੈ ਵੀ ਸਾਡੇ ਵਾਤਾਵਰਨ ਨਾਲ ਸੰਬੰਧਿਤ ਸਾਨੂੰ ਜਿਹੜੇ ਕਿ ਵੱਧ ਤੋਂ ਵੱਧ ਜਿਹੜੇ ਰੁੱਖ ਆ ਉਹ ਦਿੱਤੇ ਜਾਣ ਜਿਹਦੇ ਨਾਲ ਸਾਡੇ ਪਿੰਡ ਨੂੰ ਹੋਰ ਵਧੀਆ ਤਰੀਕੇ ਨਾਲ ਸਜਾਇਆ ਜਾ ਸਕੇ ਵਧੀਆ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਸਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤਾਂ ਕਈ ਸਹੂਲਤਾਂ ਨੇਗੀਆਂ ਜਿਹੜੇ ਸਾਡੇ ਪਿੰਡ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਹੈ ਵੀ ਸਾਡੇ ਪਿੰਡ ਦੀ ਜਿਹੜੀ ਡਿਸਪੈਂਸਰੀ ਆ ਉਹ ਕਾਫੀ ਪੁਰਾਣੀ ਆ ਤਾਂ ਉਸਨੂੰ ਢਾਹ ਕੇ ਨਵੇਂ ਤਰੀਕੇ ਦੇ ਨਾਲ ਬਣਾ ਦਿੱਤਾ ਜਾਵੇ